ਸਤਿ ਸ਼੍ਰੀ ਅਕਾਲ ਜੀ ਮੇਰਾ ਨਾਂ ਤੇਜਪਾਲਜੀਤ ਸਿੰਘ ਆ ਅਤੇ ਇੱਕ ਵਾਰ ਸਾਡਾ ਘਰ ਸਾਰਾ ਸਾਰੇ ਪਰਿਵਾਰ ਦੇ ਮੈਂਬਰ ਅਸੀਂ ਚਿੰਤਪੁਰਨੀ ਘੁੰਮਣ ਗਏ ਸੀ ਅਤੇ ਜਦੋਂ ਅਸੀਂ ਇੱਕ ਇੱਕ ਸਾਡੇ ਲਈ ਕੁੱਤਾ ਘਰ ਲਿਆਉਂਦਾ ਸੀ ਜਿਹੜਾ ਕਿ ਸਾਡਾ ਬਹੁਤ ਵਫਾ ਵਫਾਦਾਰ ਰਿਹਾ ਜੋ ਕਿ ਸਾਨੂੰ ਬਹੁਤ ਸਾਡੇ ਸਾਡੇ ਲਈ ਲਾਭਦਾਇਕ ਰਿਹਾ ਅਸੀਂ ਘੱਟੋ ਘੱਟ ਪੰਜ ਦਿਨ ਲਈ ਚਿੰਤਪੁਰਨੀ ਗਏ ਸੀ ਅਤੇ ਉੱਥੇ ਜਾਣ ਤੋਂ ਪਹਿਲਾਂ ਅਸੀਂ ਇਹਨੂੰ ਲਿਆਉਂਦਾ ਸੀ ਘੱਟੋ ਘੱਟ ਮਹੀ ਇੱਕ ਮਹੀਨਾ ਪਹਿਲਾਂ ਅਤੇ ਅਸੀਂ ਇਹਨੂੰ ਛੱਡ ਘਰ ਛ ਕੱਲੇ ਛੱਡ ਦਿੱਤਾ ਸਾਡੇ ਜਾਣ ਤੋਂ ਬਾਅਦ ਉਹਦਾ ਖਾਣਾ ਪੀਣਾ ਸਭ ਬਾਹਰ ਹੀ ਰੱਖ ਤਾ ਕਿ ਜਦੋਂ ਉਹਦਾ ਮਨ ਕਰੇ ਉਹ ਖਾ ਲੇ ਅਤੇ ਇਸ ਨਾਲ ਸਾਨੂੰ ਬਹੁਤ ਫਾਇਦਾ ਹੋਇਆ ਇਸ ਦਾ ਫਾਇਦਾ ਇਹ ਹੈ ਕਿ ਸਾਨੂੰ ਕਿਸੇ ਚੋਰ ਦਾ ਡਰ ਨਹੀਂ ਰਿਹਾ ਸਾਡੇ ਘਰ ਦੀ ਨਿਗਰਾਨੀ ਹੋਈ ਜਿਸਦਾ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਕੁੱਤੇ ਬਹੁਤ ਵਫਾਦਾਰ ਹੁੰਦੇ ਹਨ ਅਤੇ ਇੱਦਾਂ ਹੀ ਹਾਨੂੰ ਸਾਨੂੰ ਪਤਾ ਲੱਗਦਾ ਹੈ ਕਿ ਇਹਨਾਂ ਦੀ ਹੋਰ ਵਿਸ਼ੇਸ਼ਤਾਵਾਂ ਦਾ ਵੀ ਪਤਾ ਲੱਗਦਾ ਹੈ ਅਤੇ ਜਦੋਂ ਅਸੀਂ ਘਰ ਆਏ ਉਹ ਚੰਗਾ ਭਲਾ ਸੀ ਅਤੇ ਉਹਨੇ ਹਾਨੂੰ ਉਸੇ ਵੇਲੇ ਗ ਘੁੱਟ ਕੇ ਗਲ ਨਾਲ ਲਾ ਲਿਆ ਅਤੇ ਸਾਨੂੰ ਪਤਾ ਲੱਗਾ ਕਿ ਇਹ ਕਿੰਨੇ ਵਫਾਦਾਰ ਅਤੇ ਕਿੰਨੇ ਪਿਆਰੇ ਹੁੰਦੇ ਹਨ ਅਤੇ ਸਾਨੂੰ ਐਸ ਐਸੇ ਜਾਨਵਰਾਂ ਨੂੰ ਸਾਡੇ ਘਰ ਦੀ ਨਿਗਰਾਨੀ ਲਈ ਰੱਖ ਦੇਣਾ ਚਾਹੀਦਾ ਹੈ ਹੋਰ ਵੀ ਕਈ ਤਰ੍ਹਾਂ ਦੇ ਹਨ ਜਿੰਹਦਾ ਅਸੀਂ ਘਰ ਦੀ ਪਹਿਰੇਦਾਰੀ 'ਤੇ ਲਾ ਸਕਦੇ ਹਾਂ ਜੇ ਕੈਮਰੇ ਅਸੀਂ ਲਗਾ ਸਕਦੇ ਹਾਂ ਆਪਣੇ ਘਰ ਵਿੱਚ ਜਿਹਦੇ ਨਾਲ ਸਾਨੂੰ ਸਾਡੇ ਘਰ ਦੀ ਸਾਰੀ ਇਨਫੋਰਮੇਸ਼ਨ ਮਿਲਦੀ ਰਹਿੰਦੀ ਹੈ ਸਾਡਾ ਘਰ ਸੁਰੱਖਿਅਤ ਹੈ ਕਿ ਨਹੀਂ ਇਸ ਤਰ੍ਹਾਂ ਦੇ ਹੋਰ ਵੀ ਕਈ ਜਾਨਵਰ ਜਾਨਵਰ ਹੁੰਦੇ ਹਨ ਜਾਂ ਕੈਮਰੇ ਦਾ ਪ੍ਰਯੋਗ ਕਰਕੇ ਅਸੀਂ ਇਸ ਨੂੰ ਲਗਾ ਸਕਦੇ ਹਾਂ ਧੰਨਵਾਦ